ਕੁਝ ਦਿਨ ਪਹਿਲਾਂ ਸਾਡੇ ਗੁਰਦਾਸਪੁਰ ਵਿੱਚ ਇੱਕ ਤੂਫਾਨ ਆਇਆ ਸੀ ਜਿਸ ਤੂਫਾਨ ਦੇ ਸਦਕਾ ਸਾਡੇ ਘਰ ਦਾ ਜਿਹੜਾ ਲੈਸੀ ਲੈਂਡਲਾਈਨ ਟੈਲੀਫੋਨ ਬੀ ਐਸ ਐਨ ਦਾ ਐਲ ਲਗਾਇਆ ਹੋਇਆ ਉਸ ਟੈਲੀਫੋਨ ਦੀਆਂ ਜਿਹੜੀਆਂ ਤਾਰਾਂ ਹੈ ਉਹ ਖੁਰਦ ਬੁਰਦ ਹੋ ਗਈਆਂ ਜਿਸ ਕਰਕੇ ਮੈਂ ਆਪਣੇ ਮੋਬਾਈਲ ਫੋਨ ਤੋਂ ਬੀ ਐਸ ਐਨ ਐਲ ਦੇ ਅਧਿਕਾਰੀ ਨੂੰ ਫੋਨ ਕਰ ਰਿਹਾ ਨਮਸਕਾਰ ਸਰ ਸਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ੍ਹ ਤੂਫਾਨ ਦੇ ਆਉਣ ਕਰਕੇ ਸਾਡੇ ਗ ਜਿਹੜਾ ਨੰਬਰ ਹੈ ਚੌਵੀ ਚੌਂਤੀ ਸਤਾਰ੍ਹਾਂ ਜ਼ੀਰੋ ਅਠਾਰ੍ਹਾਂ ਚੁਹੱਤਰ ਉਹਦੀਆਂ ਜਿਹੜੀਆਂ ਸੇਵਾਵਾਂ ਖਤਮ ਹੋ ਚੁੱਕੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਾਡੀਆਂ ਸੇਵਾਵਾਂ ਜਿਹੜੀਆਂ ਮੁੜ ਉਜਾਗਰ ਕੀਤੀਆਂ ਜਾਣ ਤਾਂ ਕਿ ਸਾਨੂੰ ਕਿਸੇ ਨਾਲ ਗੱਲਬਾਤ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ ਤਾਂ ਕਿਰਪਾ ਕਰਕੇ ਜਲਦੀ ਤੋਂ ਜਲਦੀ ਇਹ ਜਿਹੜੀਆਂ ਤਾਰਾਂ ਉਹਨਾਂ ਨੂੰ ਠੀਕ ਕਰਨ ਦੀ ਕਿਰਪਾਲਤਾ ਕਰੋ ਜੀ ਧੰਨਵਾਦ